ਮੇਰੇ ਘਰ ਵਿੱਚ ਇੱਕ ਵਿਲੱਖਣ ਪਕਵਾਨ ਬਣਾਇਆ ਜਾਂਦਾ ਹੈ ਜਿਸ ਵਿੱਚ ਆਟੇ ਦੇ ਬੂਰੇ ਨੂੰ ਲੈ ਕੇ ਉਸਦਾ ਕੜਾਹ ਬਣਾਇਆ ਜਾਂਦਾ ਹੈ ਜਿਸ ਵਿੱਚ ਜ਼ਿਆਦਾਤਰ ਖੰਡ ਵਰਤੀ ਜਾਂਦੀ ਹੈ